ਹਾਂਜੀ ਮੈਂ ਆਪਣੇ ਕਾਲੇਜ ਵਿੱਚ ਮਨਾਏ ਜਾ ਰਹੇ ਯੂਥ ਫੈਸਟੀਵਲ ਵਿੱਚ ਹਿੱਸਾ ਲਿਆ ਹੈ ਅਤੇ ਮੈਂ ਸਾਨੂੰ ਮੈਨੂੰ ਪੇਂਟਿੰਗ ਕਰਨ ਦਾ ਬਹੁਤ ਸ਼ੌਕ ਹੈ ਮੈਨੇ ਉਸ ਪੇਂਟਿੰਗ ਵਿੱਚ ਧਰਤੀ ਦੁਆਰਾ ਇੱਕ ਪਿਚਰ ਬਣਾਈ ਹੈ ਅਤੇ ਉਸ ਪਿਕਚਰ ਨੂੰ ਪਿਕਚਰ ਦੇ ਪਿਕਚਰ ਨ ਨਾਲ ਮੈਨੂੰ ਫਸਟ ਪ੍ਰਾਈਜਰ ਪ੍ਰਾਈਜ਼ ਹਾਸ ਮਿਲਿਆ ਹੈ ਅਤੇ ਮੈਂ ਉਸ ਵਿੱਚ ਪਹਿਲੇ ਨੰਬਰ 'ਤੇ ਆਈ ਹਾਂ ਜਿਵੇਂ ਕਿ ਦੇਖਿਆ ਜਾਵੇ ਧਰਤੀ ਆਪਣੇ ਧੁਰੇ ਦੁਆਲਾ ਘੁੰਮਦੀ ਹੈ ਧਰਤੀ ਆਪਣੇ ਅਠਤਾਲੀ ਘੰਟਿਆਂ ਵਿੱਚ ਇੱਕ ਚੱਕਰ ਪੂਰਾ ਕਰਦੀ ਹੈ ਅਤੇ ਉਹਦੇ ਨਾਲ ਨਾਲ ਸਾ ਅਸੀਂ ਧਰਤੀ ਦੇ ਸਹਾਰੇ ਅਸੀਂ ਧਰਤੀ 'ਤੇ ਹੀ ਰਹਿੰਦੇ ਹਾਂ ਦੇਖਿਆ ਜਾਵੇ ਸਾਨੂੰ ਉਸਤੋਂ ਹਰਿਆਲੀ ਮਿਲਦੀ ਹੈ ਜੇ ਤਾਂ ਅਸੀਂ ਪੇੜ ਪੌਦੇ ਲਗਾਵਾਂਗੇ ਤਾਂ ਸਾਡੀ ਧਰਤੀ ਹਰੀ ਭਰੀ ਰਹੇਗੀ ਅਤੇ ਜ ਉਸ ਨਾਲ ਸਾਨੂੰ ਆਕਸੀਜਨ ਮਿਲਦੀ ਰਹੇਗੀ ਦੇਖਿਆ ਜਾਵੇ ਆਕਸੀਜਨ ਮਿਲਦੀ ਰਹੇਗੀ ਅਤੇ ਅਸੀਂ ਵਧੀਆ ਮਹਿਸੂਸ ਕਰ ਸਕਾਂਗੇ ਅਤੇ ਅਸੀਂ ਸਾਨੂੰ ਵਧੀਆ ਹੀ ਅਸ ਅਸੀਂ ਵਧੀਆ ਕਰ ਕਰ ਸਕਾਂਗੇ ਧਰਤੀ ਬਹੁਤ ਹੀ ਵਧੀਆ ਹੈ ਅਤੇ ਉਹਦੇ ਨਾਲ ਅਸ ਮੈਂ ਤੁਹਾਨੂੰ ਇਹ ਇਸਦੀ ਕਹਾਣੀ ਦੱਸੀ ਹੈ ਦੇਖਿਆ ਜਾਵੇ ਕਿ ਇਸਦੇ ਕੁਝ ਬਹੁਤ ਸਾਰੀਆਂ ਉਦਾਹਰਣਾਂ ਵੀ ਹਨ ਜੇ ਅਸੀਂ ਧਰਤੀ ਉੱਪਰ ਦਰਖ਼ਤ ਜਾਂ ਕੋਈ ਪੇੜ ਜਾਂ ਕੋਈ ਪੌਦੇ ਲਗਾਵਾਂਗੇ ਤਾਂ ਹੀਂ ਅਸੀਂ ਜੀਵਿਤ ਰਹਾਂਗੇ ਅਤੇ ਜੀਵਿਤ ਰਹਾਂਗੇ ਦੇਖ ਅਤੇ ਉਸਨੂੰ ਵਧੀਆ ਬਣਾ ਸਕੀਏ ਧਰਤੀ ਨੂੰ ਅਸੀਂ ਸਾਫ਼ ਸੁਥਰਾ ਅਤੇ ਉਸਦਾ ਆਲਾ ਦੁਆਲਾ ਵਧੀਆ ਬਣਾ ਸਕੀਏ